ਹੈਲੋ ਹਾਂਜੀ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਸੀ ਵੀ ਤੁਹਾਡਾ ਬੱਚਾ ਕਿਹੜੇ ਬੋਰਡ ਦੀ ਇਗਜ਼ਾਮ ਦੇ ਰਿਹਾ ਸੀ ਬੀ ਐਸ ਈ 'ਚ ਮੇਰਾ ਬੱਚਾ ਪੀ ਐਸ ਈ ਬੀ ਦਾ ਹੈ ਅਤੇ ਕੀ ਤੁਸੀਂ ਦੱਸ ਸਕਦੇ ਹੋ ਕਿ ਉਹਦੇ ਸੀ ਬੀ ਐਸ ਈ ਦਾ ਕੀ ਬੈਨੀਫਿਟਸ ਨੇ ਕੀ ਫਾਇਦੇ ਨੇ ਕੀ ਉਹਨਾਂ ਦਾ ਕਰੀਕੁਲਮ ਠੀਕ ਹੈ ਬੱਚਾ ਪਿੱਕਅਪ ਕਰ ਰਿਹਾ ਕਿ ਨਹੀਂ ਕਰ ਰਿਹਾ ਤੁਹਾਡੇ ਬੱਚੇ ਪਰ ਮੈਂ ਆਪ ਸੁਣਿਆ ਸੀ ਬੀ ਐਸ ਈ ਦੇ ਬੱਚਿਆਂ ਦੇ ਨੰਬਰ ਜ਼ਿਆਦਾ ਆਉਂਦੇ ਨੇ ਅਤੇ ਉਹਨਾਂ ਨੂੰ ਅੱਗੇ ਵੀ ਫਰਦਰ ਸਟਡੀ ਲਈ ਵੀ ਜ਼ਿਆਦਾ ਬੈਨੀਫਿਟਸ ਨੇ ਕੰਪੈਰੀਟੀਵਲੀ ਪੀ ਐਸ ਈ ਬੀ ਦੇ

ਪਰ ਜੇ ਪੰਜਾਬ ਦੇ ਵਿੱਚ ਗੌਰਮੈਂਟ ਜੋਬ ਲੈਣੀ ਹੋਵੇ ਤਾਂ ਪੀ ਐਸ ਈ ਬੀ ਦੇ ਬੱਚਿਆਂ ਨੂੰ ਪ੍ਰੈਫਰੈਂਸ ਮਿਲਦੀ ਹੈ ਰੂਰਲ ਏਰੀਏ ਨੂੰ ਪ੍ਰੈਫਰੈਂਸ ਮਿਲਦੀ ਹੈ ਉਹ ਵਾਲੇ ਨੰਬਰ ਫਿਰ ਸੀ ਬੀ ਐਸ ਈ ਵਾਲਿਆਂ ਨੂੰ ਨਹੀਂ ਮਿਲਦੇ ਹੋਣਗੇ ਫਿਰ ਮੈਨੂੰ ਲੱਗਦਾ

ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ